ਹੈਲੋ ਹਾਂਜੀ ਹਾਂਜੀ

ਪੰਜਾਬ ਦੇ ਸਾਰੇ ਬੱਚੇ ਬਾਹਰ ਕਿਉਂ ਜਾਂਦੇ ਆ ਬਾਹਰ ਇਸ ਲਈ ਜਾਂਦੇ ਆ ਕਈ ਤਾਂ ਜਾਂਦੇ ਆ ਪੜ੍ਹਾਈ ਕਰਨ ਪੜ੍ਹਾਈ ਦੇ ਬੇਸ 'ਤੇ ਅਤੇ ਚੱਲੋ ਉੱਥੇ ਜਾ ਕੇ ਪੜ੍ਹਾਈ ਵੀ ਕਰਦੇ ਆ ਅਤੇ ਕੁਛ ਕੁ ਘੰਟੇ ਕੰਮ ਕਰ ਲੈਂਦੇ ਆ ਅਤੇ ਕਈ ਤਾਂ ਕਹਿੰਦੇ ਆ ਵੀ ਭੇਡ ਚਾਲ ਪਈ ਹੈ ਇੱਕ ਜਣਾ ਗਿਆ ਮੇਰੀ ਭੂਆ ਦਾ ਮੁੰਡਾ ਗਿਆ ਮੈਂ ਵੀ ਜਾਣਾ ਠੀਕ ਹੈ ਤਾਂ ਕਰਕੇ ਇੱਕ ਦੂਜੇ ਦੇ ਪਿੱਛੇ ਲੱਗ ਕੇ ਰੁਝਾਨ ਵੱਧ ਗਿਆ ਅਤੇ ਉ ਇੱਕ ਤੀਜੀ ਗੱਲ ਇਹ ਵੀ ਆ ਬਈ ਇੱਥੇ ਉਹ ਕਰਦੇ ਸ਼ਰਮ ਕੰਮ ਕਰਨ ਨੂੰ ਠੀਕ ਹੈ ਇੱਥੇ ਕਹਿੰਦੇ ਵੀ ਨਹੀਂ ਅਸੀਂ ਮੱਝਾਂ ਦਾ ਕੰਮ ਨਹੀਂ ਕਰਨਾ ਜੀ ਡੇਰੀ ਫਾਰਮ ਦਾ ਨਹੀਂ ਕਰਨਾ ਬਈ ਸਾਨੂੰ ਗੋਹਾ ਲੱਗਦਾ ਇਹ ਲੱਗਦਾ ਉਹ ਤਾਂ ਬਹਾਨਾ ਹੈ ਜੀ ਸਟਡੀ ਸਟਡੀ ਦਾ ਤਾਂ ਬਹਾਨਾ ਆ ਉੱਥੇ ਜਾ ਕੇ ਉਹਨਾਂ ਨੇ ਸੈੱਟ ਹੋਣਾ ਹੁੰਦਾ ਕਰਨਾ ਉਹਨਾਂ ਨੇ ਕੰਮ ਹੀ ਆ ਉੱਥੇ ਜਾ ਕੇ ਇਹ ਤਾਂ ਬਹਾਨਾ ਆ ਉਹਨਾਂ ਦਾ ਵੀ ਚੱਲੋ ਸਟਡੀ ਵੀਜ਼ਾ ਲੈ ਕੇ ਚੱਲੇ ਹਾਂ ਜੀ ਅਤੇ ਉਹਨਾਂ ਨੇ ਪੜ੍ਹਾਈ ਥੋੜ੍ਹੀ ਕਰਨ ਜਾਂਦੇ ਜ਼ਿਆਦਾਤਰ ਤਾਂ ਬਸ ਸਿਰਫ਼ ਉੱਥੇ ਕੰਮ ਕਰਨ ਹੀ ਜਾਂਦੇ ਆ ਨਹੀਂ ਹੈ ਬੱਚੇ ਕੁਛ ਬੱਚੇ ਹੈਗੇ ਆ ਜਿਹੜੇ ਪੜ੍ਹਦੇ ਆ ਇੱਥੇ ਪੜ੍ਹ ਕੇ ਆਪਣਾ ਠੀਕ ਆ ਡਿਗਰੀਆਂ ਲੈ ਕੇ ਫਿਰ ਕੰਮ ਕਰਦੇ ਬਾਹਰ ਜਾਂਦੇ ਆ ਔਰ ਕੁਛ ਹੈਗੇ ਤਾਂ ਲੁਤਰੇ ਚੱਲੋ ਜੀ ਮੈਂ ਬਾਹਰ ਜਾਣਾ ਸਟਡੀ ਵੀਜ਼ਾ ਲੈ ਲੈਂਦੇ ਹਾਂ ਜਲਦੀ ਲੱਗ ਜੂਗਾ ਵੀਜ਼ਾ ਤਾਂ ਕਰਕੇ ਉਹ ਤਾਂ ਇੱਕ ਬਹਾਨਾ ਆ ਬਹਾਨਾ ਬਣਾ ਕੇ ਸਟਡੀ ਵੀਜ਼ਾ ਲੈ ਕੇ ਅਤੇ ਉਹ ਫਿਰ ਚੱਲੇ ਜਾਂਦੇ ਆ ਇੱਥੋਂ ਅਤੇ ਉੱਥੇ ਕੰਮ ਕਰਦੇ ਆ ਕੁਛ ਘੰਟੇ ਕੰਮ ਕਰਦੇ ਆ ਮੈਂ ਉਹ ਹੀ ਤੁਹਾਨੂੰ ਦੱਸਣ ਲੱਗਾ ਸੀ ਕਰਦੇ ਆ ਇੱਥੇ ਕਰ ਸਕਦੇ ਆ ਇੱਥੇ ਉਹ ਸ਼ਰਮ ਮੰਨਦੇ ਆ ਹੁਣ ਮੰਨ ਲਓ ਬਾਹਰ ਲਾ ਲਓ ਠੀਕ ਹੈ ਕਨੇਡਾ ਚੱਲ ਜਾਓ ਇਟਲੀ ਜਾਂਦੇ ਆ ਉੱਥੇ ਜਾ ਕੇ ਡੇਰੀ ਫਾਰਮਾਂ 'ਚ ਵੀ ਕੰਮ ਕਰਦੇ ਆ ਮੱਝਾਂ ਦਾ ਗੋਹਾ ਕੂੜਾ ਵੀ ਕਰਦੇ ਆ ਇੱਥੇ ਉਹ ਸ਼ਰਮ ਕਰਦੇ ਆ ਬਈ ਇੱਥੇ ਸਾਨੂੰ ਸ਼ਰਮ ਆਉਂਦੀ ਆ ਬਈ ਉਹ ਫਲਾਨਾ ਸਾਨੂੰ ਕੀ ਕਹੇਗਾ ਤਾਂ ਕਰਕੇ ਉਹ ਫਿਰ ਇਹਨਾਂ ਤੋਂ ਤਾਨੇ ਮਿਹਣਿਆਂ ਤੋਂ ਬਚਣ ਲਈ ਕੁਝ ਸਾਡੇ ਲੋਕਾਂ ਦੀ ਵੀ ਗਲਤੀ ਆ ਬਈ ਚੱਲੋ ਜੇ ਮੁੰਡਾ ਕੰਮ ਕਰਦਾ ਫਿਰ ਕੀ ਹੋਇਆ ਜੇ ਉਹ ਉਹਨੇ ਘਰਦੇ ਵਿੱਚ ਡੰਗਰ ਰੱਖੇ ਆ ਕੰਮ ਤਾਂ ਕਰਦਾ ਨਾ ਇੱਥੇ ਤਾਨੇ ਮਾਰ ਕੇ ਵੀ ਉਹ ਬੰਦਾ ਮੱਝਾਂ ਗੋਹਾ ਕਰਦਾ ਜੀ ਤਾਂ ਕਰਕੇ ਫਿਰ ਕੁਛ ਕੁ ਬਾਹਰ ਚੱਲ ਜਾਂਦੇ ਇਹ ਕਾਰਨ ਆ ਮੇਨ ਬਾਹਰ ਜਾਣ ਦਾ ਸਟਡੀ ਵੀਜ਼ਾ ਤਾਂ ਬਹਾਨਾ ਉਹਨਾਂ ਨੇ ਸਟਡੀ ਵੀਜ਼ਾ ਦੇ ਨਾਲ ਵੀਜ਼ਾ ਚੱਲੋ ਜਲਦੀ ਮਿਲ ਜਾਂਦਾ ਪਰ ਕਰਨਾ ਉਹਨਾਂ ਨੇ ਉੱਥੇ ਜਾ ਕੇ ਕੰਮ ਹੀ ਆ ਚਾਰ ਘੰਟੇ ਕੰਮ ਕਰੂਗੇ ਚਾਰ ਘੰਟੇ ਪੜ੍ਹ ਲਊਗੇ ਉਸ ਤੋਂ ਬਾਅਦ ਬਸ ਅਤੇ ਬਾਕੀ ਜੇ ਕਹੂਗੇ ਵੀ ਉੱਥੇ ਪੜ੍ਹਨ ਜਾਂਦੇ ਆ ਪੜ੍ਹ ਨਹੀਂ ਜਾਂਦੇ ਪੜ੍ਹਨ ਨੂੰ ਤਾਂ ਇੱਥੇ ਵੀ ਬਥੇਰੇ ਕੋਲਜ ਹੈਗੇ ਆ ਜ਼ਰੂਰੀ ਥੋੜ੍ਹੀ ਉੱਥੇ ਪੜ੍ਹਨ ਜਾਣਾ ਇੱਥੇ ਥੋੜ੍ਹੇ ਕੋਲਜ ਆ ਇੱਥੇ ਪੜ੍ਹਾਈ ਹੁੰਦੀ ਸਾਰਾ ਕੁਛ ਹੁੰਦਾ

ਧੰਨਵਾਦ